ਸਤਿ ਸ਼੍ਰੀ ਅਕਾਲ ਜੀ ਹਾ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਆਜੋ ਬੈਠੋ ਮੈਮ ਹਾਂਜੀ ਪਹਿਲੀ ਛਮਾਈ ਦੇ ਪੇਪਰ ਹੋਏ ਸੀ ਜੀ ਉਹਦਾ ਰਿਜ਼ਲਟ ਆਹ ਦੇਖੋ ਇਹਦੇ ਕਿ ਸਾਰੇ ਸਬਜੈਕਟਾਂ ਚੋਂ ਵਧੀਆ ਨੰਬਰ ਆਏ ਆ ਪਰ ਇੱਕ ਸਬਜੈਕਟ ਆ ਮੈਥ ਵਿੱਚੋਂ ਮੈਥ ਚੋਂ ਵੀਕ ਹੈ ਜਿਹਦੇ ਵਿੱਚ ਨੰਬਰ ਇਹਦੇ ਘੱਟ ਆਏ ਹੈ ਨਹੀਂ ਨਹੀਂ ਜ਼ਰੂਰ ਹਾਂਜੀ ਕੋਸ਼ਿਸ਼ ਕਰੂੰਗੀ ਮੈਂ ਇਹਦੇ ਵਿੱਚੋਂ ਵੀਕ ਆ ਇਹ ਨਾ ਥੋੜ੍ਹਾ ਸ਼ੈਤਾਨ ਹੈਗਾ ਨਾ ਅਤੇ ਜਿਹਦੇ ਕਰਕੇ ਧਿਆਨ ਨਹੀਂ ਦਿੰਦਾ ਸ਼ੈਤਾਨੀਆਂ ਕਰਦਾ ਰਹਿੰਦਾ ਹੈ ਹਾਂ ਅਤੇ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰੂੰਗੀ ਅੱਗੇ ਨਾਲੋਂ ਕਿ ਇਹਦੇ ਜਿਹੜਾ ਹੈ ਉਹ ਇਹਦੇ ਵਿੱਚੋਂ ਵੀ ਨੰਬਰ ਵਧੀਆ ਆਣ ਹਾਂਜੀ ਕ ਉਹ ਕਿਸੇ ਟੈਮ ਮੈਮ ਇੱਦਾਂ ਹੋ ਜਾਂਦਾ ਸਾਨੂੰ ਸਕੂਲੋਂ ਕੋਈ ਪ੍ਰਿੰਸੀਪਲ ਮੈਮ ਕੋਈ ਕੰਮ ਦੇ ਦਿੰਦੇ ਜਿਹਦੇ ਕਰਕੇ ਸਾਡੇ ਕੋਲ ਟਾਈਮ ਨਹੀਂ ਲੱਗਦਾ ਕੰਮ ਕਰਵਾਉਂਣ ਬਾਕੀ ਇਹ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨਾ ਵੀ ਹੋ ਸਕੇ ਅਤੇ ਕਰਵਾਉਂਦੇ ਹਾਂ ਜਾਂ ਦੂਜਾ ਟੀਚਰ ਕੋਈ ਕਰਵਾ ਦਿੰਦਾ ਹੈ ਅਤੇ ਕੋਈ ਗੱਲ ਨਹੀਂ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਇਸ ਚੀਜ਼ ਦਾ ਕਿ ਹੋ ਜਾਏ ਇਹਦਾ ਬੱਚੇ ਦਾ ਵਧੀਆ ਨੰਬਰ ਆਉਣ ਅੱਗੇ ਨੂੰ ਅਤੇ ਆਹ ਮੈਮ ਰਿਜ਼ਲਟ ਲੈ ਜਾਓ ਬੱਚੇ ਦਾ ਆਪਣੇ ਦਾ ਓਕੇ ਜੀ ਓਕੇ ਜੀ ਧੰਨਵਾਦ